ਹੈਲੋ ਸਤਿ ਸ਼੍ਰੀ ਅਕਾਲ ਸਰ ਤੁਸੀਂ ਜਸਵੰਤ ਸਿੰਘ ਬੋਲਦੇ ਹੋ ਜੀ ਐਸ ਟੀ ਡਿਪਾਰਟਮੈਂਟ ਤੋਂ ਹਾਂਜੀ ਸਰ ਮੈਨੂੰ ਮੇਰੀ ਫਰੈਂਡ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਹਾਂਜੀ ਤੇ ਸਰ ਮੇਰਾ ਨਾ ਇੱਕ ਮਤਲਬ ਕਿ ਕਾਰੋਬਾਰ ਮਤਲਬ ਕਿ ਪੋਲਟਰੀ ਫਾਰਮ ਦਾ ਹੈਗਾ ਕੰਮ ਕਾਰ ਤੇ ਸਰ ਮੈਂ ਨਾ ਉਹਦੇ ਰਿਗਾਰਡਿੰਗ ਮੈਂ ਸੋਚ ਰਹੀ ਸੀ ਕਿ ਮਤਲਬ ਥੋੜਾ ਜਿਹਾ ਹੋਰ ਵਧਾ ਲਈਏ ਹਨਾ ਤੇ ਉਹਦੇ ਲਈ ਮੈਨੂੰ ਜੀ ਐਸ ਟੀ ਦੀ ਰਿਕੁਆਇਰਮੈਂਟ ਬਾਰੇ ਸੀਗੀ ਥੋੜੀ ਬਹੁਤ ਮੈਂ ਜੀ ਐਸ ਟੀ ਬਾਰੇ ਪੁੱਛਣਾ ਸੀ ਤੁਹਾਨੂੰ ਹਾਂਜੀ ਸਰ ਤੇ ਮਤਲਬ ਵੀ ਕਿ ਜਿਵੇਂ ਹੁਣ ਮੈਨੂੰ ਉਹਦੇ ਲਈ ਕੀ ਕੀ ਪ੍ਰੋਸੀਜਰ ਹੋਊਗਾ ਜਿਵੇਂ ਆਪਾਂ ਉਹਦੇ ਚ ਰਜਿਸਟਰ ਕਰਾਣਾ ਹੋਵੇ ਹਨਾ ਤੇ ਮੈਨੂੰ ਕੀ ਕਹਿੰਦਾ ਫਾਇਦਾ ਹੋਊਗਾ ਕੀ ਕੀ ਮਤਲਬ ਨੁਕਸਾਨ ਜੋ ਵੀ ਹੈਨਾ ਸਰ ਹਾਂਜੀ ਸਰ ਮੈਂ ਸਾਰੀ ਫੈਸਿਲਿਟੀਜ ਵਗੈਰਾ ਹਾਂਜੀ ਸਰ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਮੈਨੂੰ ਦੇਣ ਲਈ ਤੇ ਸਰ ਜੇ ਮੈਨੂੰ ਕੋਈ ਹੋਰ ਵੀ ਪ੍ਰੋਬਲਮ ਹੋਈ ਤਾਂ ਮੈਂ ਥੋਨੂੰ ਜ਼ਰੂਰ ਗੱਲ ਕਰੂਗੀ ਥੋਡੇ ਨਾਲ ਹਾਂਜੀ ਸਰ ਥੈਂਕਯੂ ਸਰ